ਹਾਂਜੀ ਨਮਸਕਾਰ ਜੀ ਤੁਸੀਂ ਬਰਤਨਾਂ ਵਾਲੀ ਦੁਕਾਨ ਤੋਂ ਬੋਲਦੇ ਹੋ ਹਾਂਜੀ ਉਹ ਮੈਨੂੰ ਨਾ ਸਾਡੇ ਘਰ ਇੱਕ ਨਾ ਫੰਕਸ਼ਨ ਹੈਗਾ ਅਤੇ ਉਹਦੇ ਵਾਸਤੇ ਮੈਨੂੰ ਵੱਡੇ ਵੱਡੇ ਬਰਤਨ ਚਾਹੀਦੇ ਹੈ ਵੱਡੇ ਵੱਡੇ ਪਤੀਲੇ ਕੜਾਹੀਆਂ ਹੋ ਗਈਆਂ ਜਿਵੇਂ ਟੋਪ ਹੋ ਗਏ ਇਹ ਦਸ ਦਸ ਕਿਲੋ ਵਾਲੇ ਤਾਂ ਹੋਣ ਹੀ ਹਾਂਜੀ ਹਾਂਜੀ ਹਾਂਜੀ ਅਤੇ ਕੜਾਹੀਆਂ ਵੀ ਥੋੜ੍ਹੀਆਂ ਭਾਰੀਆਂ ਹੋਣ ਜਵਾਂ ਹਲਕੀਆਂ ਨਾ ਹੋਣ ਇਹ ਨਾ ਹੋਵੇ ਵੀ ਮਤਲਬ ਆਪਾਂ ਸਮਾਨ ਬਣਾਈਏ ਤਾਂ ਵਿੱਚ ਸੜ ਜਾਵੇ ਉਹਨਾਂ ਦਾ ਹਾਂਜੀ ਉਹ ਵੀ ਉਹ ਵੀ ਬਣਾਣੀਆਂ ਅਸੀਂ ਅਤੇ ਜਿਵੇਂ ਹਲਵਾ ਹਲਵੇ ਦਾ ਪ੍ਰਸ਼ਾਦ ਵਗੈਰਾ ਵੀ ਬਣੇਗਾ ਅਤੇ ਇੱਕ ਹਾਂਜੀ ਅਤੇ ਇੱਕ ਮਤਲਬ ਜਿਵੇਂ ਅਸੀਂ ਗੱਚਕ ਵਗੈਰਾ ਬਣਾਉਣ ਵਾਸਤੇ ਵੀ ਲੈਣੀ ਆ ਕੜਾਹੀ ਵੱਡੀ ਸਾਰੀ ਇਹ ਮੈਨੂੰ ਤਿੰਨ ਕੜਾਹੀਆਂ ਚਾਹੀਦੀਆਂ ਅਤੇ ਚਾਰ ਟੋਪ ਚਾਹੀਦੇ ਆ ਹਾਂਜੀ ਅਤੇ ਚਾਰ ਹੀ ਮਤਲਬ ਵੱਡੇ ਵੱਡੇ ਪਤੀਲੇ ਹੋ ਜਾਣ ਜਿਵੇਂ ਉਹ ਚਾਹੀਦੇ ਹੈ ਅਤੇ ਦੋ ਇਹ ਸਿਲਵਰ 'ਚ ਹੀ ਮੈਨੂੰ ਚਾਹੀਦੇ ਹੈ ਸਟੀਲ ਵਾਲੇ ਨਹੀਂ ਚਾਹੀਦੇ ਮੈਨੂੰ ਹਾਂਜੀ ਮਿਲ ਜਾਣਗੇ ਮੈਨੂੰ ਹਾਂਜੀ ਕਿਉਂਕਿ ਹਾਂਜੀ ਮੈਂਨੂੰ ਪਰਸੋਂ ਤੱਕ ਚਾਹੀਦੇ ਹੈ ਹਾਂਜੀ ਬਸ ਹਾਂਜੀ ਬਸ ਹਾਂਜੀ ਬਸ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਸ ਇਹ ਵੇਖਣਾ ਵੀ ਆਪਾਂ ਥੱਲਾਂ ਮਜ਼ਬੂਤ ਹੋਣਾ ਚਾਹੀਦਾ ਤਾਂ ਕਿ ਆਪਣਾ ਬਣਾਇਆ ਸਮਾਨ ਸੜੇ ਨਾ ਹਾਂਜੀ ਅਤੇ ਏ ਇਹ ਕਿਸ ਰੇਟ ਦੇ ਬਣ ਜਾਣਗੇ ਆਪਾਂ ਨੂੰ ਠੀਕ ਹੈ ਜੀ ਕੋਈ ਗੱਲ ਨਹੀਂ ਬਾਕੀ ਤਾਂ ਚੱਲੋ ਠੀਕ ਹੈ ਕੋਈ ਗੱਲ ਨਹੀਂ ਫਿਰ ਮੈਂ ਤੁਹਾਡੇ ਕੋਲ ਕੱਲ੍ਹ ਆਵਾਗੀ ਲੈ ਮਤਲਬ ਦੇਖਣ ਵਾਸਤੇ ਅਤੇ ਫਿਰ ਕੱਲ੍ਹ ਤੱਕ ਤੁਸੀਂ ਨਹੀਂ ਨਹੀਂ ਪਰਸੋਂ ਤਾਂ ਮੈਨੂੰ ਪਰਸੋਂ ਮੈਨੂੰ ਚਾਹੀਦੇ ਹੈ ਕੱਲ੍ਹ ਆਪਾਂ ਦੇਖਾਂਗੇ ਵੇਖਾ ਅਗਰ ਨਹੀਂ ਮੈਨੂੰ ਸਹੀ ਲੱਗੇ ਹਾਂਜੀ ਹਾਂਜੀ ਅਗਰ ਜੇ ਮੈਨੂੰ ਨਹੀਂ ਸਹੀ ਲੱਗਣਗੇ ਤਾਂ ਫਿਰ ਮੈਂ ਤੁਹਾਨੂੰ ਕਹਿ ਸਕੂੰਗੀ ਨਾ ਵੀ ਥੋੜ੍ਹੇ ਮੈਨੂੰ ਹੋਰ ਹਾਂਜੀ ਹਾਂਜੀ ਹਾਂਜੀ ਹਾਂਜੀ ਫਿਰ ਕਈ ਵਾਰ ਐਟ ਏ ਟਾਈਮ ਖਰਾਬ ਨਾ ਆਉਣਾ ਪਵੇ ਨਾ ਤਾਂ ਕਰਕੇ ਮਤਲਬ ਫਿਰ ਕੱਲ੍ਹ ਠੀਕ ਹੈ ਮੈਂ ਸ਼ਾਮ ਨੂੰ ਪੰਜ ਵਜੇ ਤੱਕ ਆ ਜਾਵਾਂਗੀ ਤੁਹਾਡੇ ਕੋਲ ਠੀਕ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਠੀਕ ਹੈ ਠੀਕ ਹ ਜੀ ਕੋਈ ਗੱਲ ਨਹੀਂ ਓਕੇ ਜੀ ਓਕੇ ਓਕੇ